ਮੈਂ ਨਾ ਆਨਲਾਈਨ ਇੱਕ ਸਕਰਟ ਮੰਗਵਾਉਣੀ ਸੀ ਅਤੇ ਮੈਂ ਨਾ ਇਸ ਲਈ ਇੱਥੇ ਅਲੱਗ ਅਲੱਗ ਵੈਬਸਾਈਟਸ ਦੇਖੀਆਂ ਜੇ ਮੰਤਰਾ 'ਤੇ ਚੈੱਕ ਕੀਤਾ ਐਮਾਜੋਨ 'ਤੇ ਚੈੱਕ ਕੀਤਾ ਫਲਿੱਪਕਾਟ 'ਤੇ ਚੈੱਕ ਕੀਤਾ ਸੀ ਅਤੇ ਉੱਥੇ ਮੈਂ ਜਿਹੜਾ ਮੈਨੂੰ ਮੈਨੂੰ ਰੰਗ ਪਸੰਦ ਕਰਨਾ ਸੀ ਨਾ ਉਹ ਰੰਗ ਮੈਨੂੰ ਮਤਲਬ ਉਹ ਲੱਭਣ ਲਈ ਮੈਂ ਅਲੱਗ ਅਲੱਗ ਸਾਈਡਾਂ ਸਾਈਟਾਂ 'ਤੇ ਗਈ ਅਤੇ ਫੈਬਰਿਕ ਵੀ ਮੈਨੂੰ ਮੇਰੇ ਮਨਪਸੰਦ ਦਾ ਸਾਈਜ਼ ਵਗੈਰਾ ਸਭ ਕੁਝ ਕੀਤਾ ਮੈਂ ਨਾ ਐਨਾਜੋਨ 'ਤੇ ਚੈੱਕ ਕੀਤਾ ਉੱਥੇ ਨਾ ਮੈਨੂੰ ਮੇਰਾ ਸਾਈਜ਼ ਨਹੀਂ ਮਿਲਿਆ ਕਲਰ ਤਾਂ ਮੈਨੂੰ ਮਿਲ ਗਿਆ ਸੀ ਮੇਰਾ ਅਤੇ ਫੈਬਰਿਕ ਵੀ ਸਹੀ ਸੀ ਉੱਥੇ ਫਿਰ ਮੈਂ ਨਾ ਉੱਥੇ ਫਲਿੱਪਕਾਟ 'ਤੇ ਵੇਖੇ ਆ ਫਲਿਪਕਾਟ 'ਤੇ ਮੈਨੂੰ ਨਾ ਵਧੀਆ ਲੱਗਿਆ ਪਰ ਇੰਨਾਂ ਨਹੀਂ ਵਧੀਆ ਲੱਗਾ ਫਿਰ ਮੈਂ ਮੰਤਰਾ 'ਤੇ ਵੇਖਿਆ ਉਥੇ ਮੈਨੂੰ ਫੈਬਰਿਕ ਮੇਰਾ ਮਨਪਸੰਦ ਵੀ ਮਿਲ ਗਿਆ ਸੀ ਅਤੇ ਕਲਰ ਵੀ ਮੈਨੂੰ ਬਲੈਕ ਚਾਹੀਦਾ ਸੀ ਉਹ ਵੀ ਮੈਨੂੰ ਮਿਲ ਗਿਆ ਅਤੇ ਫਿਰ ਮੈਂ ਸਾਈਜ਼ ਵੇਖਿਆ ਸਾਈਜ ਵੀ ਠੀਕ ਸੀ ਫਿਰ ਮੈਂ ਨਾ ਆਨਲਾਈਨ ਮੰਗਵਾ ਲਈ ਅਤੇ ਉੱਥੇ ਉਹਨਾਂ ਨੂੰ ਮੈਂ ਪੁੱਛਿਆ ਵੀ ਕਦੋਂ ਤੱਕ ਆ ਜੂਗੀ ਅਤੇ ਉਹ ਕਹਿੰਦੇ ਵੀ ਆਜੂ ਵੀ ਜ ਜਦੋਂ ਤੁਹਾਨੂੰ ਚਾਹੀਦੀ ਹੈ ਉਹ ਉਹਨੂੰ ਉਹ ਜਦੋਂ ਤੁਸੀਂ ਆਡਰ ਕਰੋਗੇ ਉਹਦੇ ਤੋਂ ਬਾਅਦ ਛੇ ਜਾਂ ਸੱਤ ਦਿਨ ਬਾਅਦ ਕ ਆ ਜਾਵੇਗੀ ਅਤੇ ਮੈਂ ਵੇਖਿਆ ਮੈਂ ਮੈਂ ਕਿਹਾ ਵੀ ਮੈਨੂੰ ਬਲੈਕ ਦੇ ਨਾਲ ਨਾਲ ਇੱਕ ਰੈਡ ਕਲਰ ਦੀ ਵੀ ਚਾਹੀਦੀ ਹੈ ਅਤੇ ਉਹ ਕਹਿੰਦੇ ਹਾਂ ਕੋਈ ਗੱਲ ਨਹੀਂ ਤੁਹਾਨੂੰ ਮਿਲ ਜਾਏਗੀ ਪਰ ਫਿਰ ਮੈਂ ਰੈਡ 'ਚ ਵੇਖਿਆ ਅਤੇ ਉਹ ਨਾ ਉਹਦੇ ਵਿੱਚ ਆਕਾਰ ਸਹੀ ਨਹੀਂ ਹੈਗਾ ਸੀ ਅਤੇ ਫਿਰ ਉਹ ਕਹਿੰਦੇ ਨਹੀਂ ਤੁਹਾਨੂੰ ਸਾਈਜ਼ ਤੁਹਾਡਾ ਸਹੀ ਕਰਕੇ ਤੁਹਾਨੂੰ ਸੈਂਡ ਕਰ ਦੇਵਾਂਗੇ ਮੈਂ ਕਿਹਾ ਚਲ ਠੀਕ ਹੈ ਵੀ ਤੁਸੀਂ ਮੈਨੂੰ ਪਸੰਦ ਕਰਕੇ ਅਤੇ ਸਲੈਕਟ ਕਰਕੇ ਤੁਸੀਂ ਮੈਨੂੰ ਸੈਂਡ ਕਰ ਦਿਆ ਜੇ ਠੀਕ ਹੈ